ਵੈਸੇ ਤਾਂ ਰੋਜ਼ ਮਰ੍ਹਾ ਦੇ ਜੀਵਨ ਵਿੱਚ ਕਈ ਘਟਨਾਵਾਂ ਹੁੰਦੀਆਂ ਹਨ ਪਰ ਜੇ ਮੈਂ ਤੁਹਾਨੂੰ ਇੱਕ ਦਿਲਚਸਪ ਖ਼ਬਰ ਦੀ ਗੱਲ ਦੱਸਾਂ ਤਾਂ ਇੱਕ ਗੇਮਿੰਗ ਐਪ ਦੌਰਾਨ ਦੋ ਅਲੱਗ ਅਲੱਗ ਕੰਟਰੀ ਦੇ ਲੋਕ ਮਿਲੇ ਅਤੇ ਉਸ ਗੇਮਿੰਗ ਐਪ ਦੌਰਾਨ ਹੀ ਉਹਨਾਂ ਨੂੰ ਪਿਆਰ ਹੋ ਗਿਆ ਅਤੇ ਜਿਹੜੀ ਕੁੜੀ ਆਪਣੀ ਕੰਟਰੀ ਛੱਡ ਕੇ ਆਪਣੇ ਤਿੰਨ ਬੱਚਿਆਂ ਨਾਲ਼ ਭਾਰਤ ਆ ਗਈ ਅਤੇ ਆ ਕੇ ਉਸ ਮੁੰਡੇ ਨਾਲ਼ ਪਿਆਰ ਕਰਨ ਦਾ ਦਾਅਵਾ ਕਰਨ ਲੱਗ ਗਈ ਪਰ ਮਜ਼ੇਦਾਰ ਗੱਲ ਤਾਂ ਉਦੋਂ ਹੋਈ ਜਦੋਂ ਸਰਕਾਰ ਨੇ ਉਸ ਲੇਡੀ ਨੂੰ ਏਜੰਸੀ ਦੀ ਦਾ ਇੱਕ ਇਮਪਲੋਈ ਪਾਕਿਸਤਾਨ ਏਜੰਸੀ ਦਾ ਇੱਕ ਇਮਪਲੋਈ ਦੱਸਿਆ ਅਤੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ